ਹਾਂਜੀ ਮੈਂ ਇੱਕ ਵਾਰ ਕੋਲਜ ਪੜ੍ਹਦੇ ਟਾਈਮ ਮਿੱਕੀ ਮਾਊਸ ਦੀ ਡਰਾਇੰਗ ਬਣਾਈ ਸੀ ਚਾਹੇ ਕਿ ਮੇਰੇ ਵਰਗੇ ਅਨਾੜੀ ਲਈ ਕਾਫੀ ਔਖਾ ਸੀ ਪਰ ਫਿਰ ਵੀ ਮੈਂ ਕਾਫੀ ਅੱਛੀ ਬਣਾਈ ਮੇਰੀ ਜਿਹੜੀ ਕੋਸ਼ਿਸ਼ ਸੀ ਕਾਫੀ ਸਫਲ ਰਹੀ ਅਤੇ ਉਹਦੇ ਵਿੱਚ ਮੈਂ ਉਸਦੀਆਂ ਜਦੋਂ ਅੱਖਾਂ ਬਣਾਈਆਂ ਕੰਨ ਬਣਾਏ ਅਤੇ ਉਹਦਾ ਚਿਹਰਾ ਬਣਾਇਆ ਤਾਂ ਉਹ ਕਾਫੀ ਜਿਹੜਾ ਦੌਰ ਸੀ ਉਹ ਮੁਸ਼ਕਿਲ ਸੀ ਅਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਰੇਜ ਕਰਕੇ ਦੁਬਾਰਾ ਬਣਾ ਕੇ ਕੋਸ਼ਿਸ਼ ਕਰਦੇ ਕਰ ਕਰ ਕੇ ਫਿਰ ਇੱਕ ਬੜੀ ਅੱਛੀ ਡਰਾਇੰਗ ਤਿਆਰ ਹੋਈ ਜਿਹੜੀ ਕਿ ਮੇਰੀਆਂ ਸ ਸਹੇਲੀਆਂ ਨੂੰ ਕਾਫੀ ਪਸੰਦ ਆਈ ਅਤੇ ਬਹੁਤ ਸਾਰੀਆਂ ਨੇ ਤਾਂ ਉਸ ਦੀ ਫੋਟੋ ਵੀ ਖਿੱਚੀ ਅਤੇ ਉਹਨਾਂ ਨੇ ਕਾਫੀ ਇਸ ਬਾਰੇ ਮੈਨੂੰ ਮੇਰੀ ਤਾਰੀਫ ਕੀਤੀ ਕਿ ਜਿਹੜੇ ਮਿੱਕੀ ਮਾਊਸ ਦਾ ਚਿੱਤਰ ਬਣਾਇਆ ਹੈ ਇਹ ਕਾਫੀ ਅੱਛਾ ਹੈ ਕਾਫੀ ਵਧੀਆ ਹੈ ਅਤੇ ਉਹਨਾਂ ਨੇ ਵੀ ਮੈਨੂੰ ਇਹ ਮੈਨੂੰ ਪੇਸ਼ਕਸ਼ ਕੀਤੀ ਕਿ ਉਹ ਮੈਂ ਉਹਨਾਂ ਦੇ ਵੀ ਨੋਟਸ ਦੇ ਸਾਹਮਣੇ ਇਹ ਇੱਕ ਚਿੱਤਰ ਜਿਹੜਾ ਹੈ ਬਣਾ ਕੇ ਦੇਵਾਂ ਕਿਉਂਕਿ ਉਹਨਾਂ ਨੂੰ ਇਹ ਕਾਫੀ ਪਸੰਦ ਆਇਆ ਸੀ